ਸੈਰ ਸਪਾਟਾ ਸਾਡੇ ਖੇਤਰ ਵਿੱਚ ਇੱਕ ਰੁਜ਼ਗਾਰ ਦਾ ਮੌਕਾ ਬਣਦਾ ਹੈ ਜਿਵੇਂ ਕਿ ਲੋਕ ਚੰਡੀਗੜ੍ਹ ਮੋਹਾਲੀ ਉੱਥੇ ਘੁੰਮਣ ਆਉਂਦੇ ਹਨ ਜਿਹੜੇ ਵੀ ਪਿੰਡਾਂ ਦੇ ਵਿੱਚ ਲੋਕ ਇੱਥੇ ਘੁੰਮਣ ਆਉਂਦੇ ਹਨ ਉਨ੍ਹਾਂ ਨੂੰ ਇੱਥੇ ਬਹੁਤ ਹੀ ਵਧੀਆ ਜਗ੍ਹਾਵਾਂ ਨੇ ਜਿਹੜੀਆਂ ਕਿ ਦੇਖ ਕੇ ਲੋਕ ਬਹੁਤ ਜ਼ਿਆਦਾ ਖੁਸ਼ ਹੁੰਦੇ ਹਨ ਅਤੇ ਨਾਲ਼ ਦੀ ਨਾਲ਼ ਇੱਥੇ ਜਿਹੜਾ ਰੁਜ਼ਗਾਰ ਹੈ ਉਹ ਬਹੁਤ ਜ਼ਿਆਦਾ ਮਿਲਦਾ ਹੈ ਜਿੰਨਾ ਕਿ ਅਸੀਂ ਪਿੰਡਾਂ ਦੇ ਵਿੱਚ ਨਹੀਂ ਲੱਭ ਸਕਦੇ ਅਤੇ ਜਿਹੜਾ ਰੁਜ਼ਗਾਰ ਇੱਥੇ ਮਿਲਦਾ ਹੈ ਉਹਦੇ ਨਾਲ਼ ਹੀ ਜਿਹੜੇ ਪਿੰਡਾਂ ਦੇ ਵਿੱਚੋਂ ਇੱਥੇ ਆ ਕੇ ਰਹਿੰਦੇ ਹਨ ਲੋਕ ਉਨ੍ਹਾਂ ਨੂੰ ਜਿਹੜੀਆਂ ਸੁਵਿਧਾਵਾਂ ਹਨ ਜੋ ਕਿ ਸਾਨੂੰ ਕਿ ਪਿੰਡਾਂ ਦੇ ਵਿੱਚ ਨਹੀਂ ਮਿਲਦੀਆਂ ਉਹ ਇੱਥੇ ਆਰਾਮ ਨਾਲ਼ ਮਿਲ ਜਾਂਦੀਆਂ ਹਨ ਜਿਵੇਂ ਕਿ ਰੈਸਟੋਰੈਂਟ ਵਾਲ਼ੇ ਉਨ੍ਹਾਂ ਦੀ ਇਨਕਮ ਸੋਰਸ ਵੱਧ ਜਾਂਦੀ ਹੈ ਜਿਵੇਂ ਕਿ ਪਿੰਡਾਂ ਤੋਂ ਆ ਕੇ ਰਹਿਣਾ ਤਾਂ ਫਿਰ ਅਗਲਿਆਂ ਨੇ ਦੋ ਤਿੰਨ ਦਿਨ ਉੱਥੇ ਸਟੇਅ ਕਰਨਾ ਹੁੰਦਾ ਤਾਂ ਉਹਦੇ ਨਾਲ਼ ਉਨ੍ਹਾਂ ਦੀ ਇਨਕਮ ਸੋਰਸ ਹੋ ਜਾਂਦੀ ਹੈ ਅਤੇ ਦੂਜਾ ਜਿਵੇਂ ਰੈਸਟੋਰੈਂਟ ਤੋਂ ਔਨਲਾਈਨ ਓਡਰ ਕਰਨਾ ਕਿਸੇ ਨੇ ਜਿਵੇਂ ਟੈਕਸੀ ਵਾਲ਼ਿਆਂ ਨੇ ਕੈਬ ਓਡਰ ਕ ਕਿਤੇ ਜਾਣਾ ਤਾਂ ਉਹ ਲੋਕੇਸ਼ਨ ਪਾ ਦਿੰਦੇ ਹਨ ਜੋ ਕਿ ਅੱਜ ਦੇ ਟਾਈਮ ਦੇ ਬ ਵਿੱਚ ਬਹੁਤ ਜ਼ਿਆਦਾ ਸੌਖਾ ਤਰੀਕਾ ਹੈ ਕਿ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਣ ਵਾਸਤੇ ਉਹ ਇੱਕ ਕੈਬ ਨੂੰ ਬੁੱਕ ਕਰਦੇ ਹਨ ਅਤੇ ਜਿਹੜੇ ਕੈਬ ਵਾਲ਼ੇ ਹਨ ਉਨ੍ਹਾਂ ਨੂੰ ਆਪਣੀ ਇੱਕ ਰੁਜ਼ਗਾਰ ਮਿਲ ਜਾਂਦਾ ਹੈ ਪੈਸੇ ਕਮਾਉਣ ਦਾ ਤਰੀਕਾ ਮਿਲ ਜਾਂਦਾ ਹੈ